ਹੈਲੋ ਜਿਵੇਂ ਕਿ ਭਾਰਤ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਸੈਲਾਨੀਆਂ ਦੇ ਘੁੰਮਣ ਫਿਰਨ ਵਾਸਤੇ ਹਰੇਕ ਰਾਜ ਦੇ ਵਿੱਚ ਬਹੁਤ ਹੀ ਆਕਰਸ਼ਿਤ ਦੇਖਣ ਵਾਲੇ ਸਥਾਨ ਹੈ ਮੈਂ ਗੱਲ ਕਰਦਾ ਆਪਣੇ ਸਟੇਟ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਹੀ ਘੁੰਮਣ ਅਤੇ ਦੇਖਣਯੋਗ ਸਥਾਨ ਹਨ ਜਿਵੇਂ ਕਿ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਪੂਰੇ ਵਰਲਡ ਦੇ ਵੱਖ ਵੱਖ ਸੈਲਾਨੀ ਆ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਹੀ ਬਾਘਾ ਬਾਰਡਰ ਜ਼ਿਲ੍ਹਿਆਂ ਵਾਲਾ ਬਾਗ ਦੁ ਦੁਰਗਿਆਣਾ ਮੰਦਰ ਹੋਰ ਵੀ ਬਹੁਤ ਹੀ ਕੁਝ ਦੇਖਣ ਵਾਲੇ ਸਥਾਨ ਹੈ ਇੰਟਰਨੈਸ਼ਨਲ ਏਅਰਪੋਰਟ ਵੀ ਹੈ ਜੀ ਇੱਥੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅੰਮ੍ਰਿਤਸਰ ਆਪਣੇ ਅਨੰਦਪੁਰ ਸਾਹਿਬ ਪਟਿਆਲੇ ਦੇ ਵਿੱਚ ਦੂਖਨਿਵਾਰਨ ਸਾਹਿਬ ਗੁਰਦੁਆਰਾ ਜੀ ਜਲੰਧਰ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਦੇਖਣ ਯੋਗ ਹਨ ਅਗਲੇ ਸਟੇਟ ਦੇ ਵਿੱਚ ਜਿਵੇਂ ਆਪਾਂ ਦਿੱਲੀ ਦੀ ਕਰਦੇ ਦਿੱਲੀ ਦੇ ਵਿੱਚ ਲਾਲ ਕਿਲ੍ਹਾ ਅਤੇ ਕ਼ੁਤੁਬ ਮੀਨਾਰ ਅਤੇ ਕਾਫੀ ਕੁਝ ਅਤੇ ਨਵਾਂ ਪਾਰਲੀਮੈਂਟ ਹਾਊਸ ਜਿਹੜਾ ਕਿ ਹੁਣੇ ਰੀਸੈਂਟਲੀ ਇੰਡੀਅਨ ਗੋਰਮੈਂਟ ਨੇ ਚਲਾਇਆ ਹੈ ਉਹ ਵੀ ਇੱਕ ਨਵਾਂ ਦੇਖਣਯੋਗ ਅਸਥਾਨ ਬਣਿਆ ਹੈ ਜੀ ਬਿਹਾਰ ਦੇ ਵਿੱਚ ਚੱਲ ਜੀਏ ਉੱਥੇ ਤਖ਼ਤ ਸ਼੍ਰੀ ਪੰਜਾਂ ਤਖ਼ਤਾਂ ਦੇ ਵਿੱਚ ਪਟਨਾ ਸਾਹਿਬ ਗੁਰਦੁਆਰਾ ਹੋਰ ਵੀ ਯਾਨੀ ਪੂਰੇ ਭਾਰਤ ਦੇ ਵਿੱਚ ਹਰੇਕ ਸਟੇਟ ਦੇ ਬਹੁਤ ਕੁਝ ਦੇਖਣ ਵਾਲੇ ਸਥਾਨ ਹੈ